ਪੰਜਾਬ ਦੇ ਵਿੱਚ ਕਈ ਸਿਆਸੀ ਪਾਰਟੀਆਂ ਹੈਗੀਆਂ ਜਿੱਦਾਂ ਕਿ ਸ਼੍ਰੋਮਣੀ ਅਕਾਲੀ ਦਲ ਹੈ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਦੇ ਆਪਣੇ ਆਪਣੇ ਪ੍ਰਮੁੱਖ ਜਿਹੜੇ ਸਿਆਸਤਦਾਨ ਹੈਗੇ ਐ ਜਿੱਦਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹੈਗੇ ਆ ਇਸ ਟਾਈਮ ਭਗਵੰਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਆ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਬਦਲਦੇ ਰਹਿੰਦੇ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀਗੇ ਸਾਡੇ ਉਹ ਫਿਰ ਬੀ ਜੇ ਪੀ ਚ ਚਲੇ ਗਏ ਤੇ ਹੋਰ ਵੀ ਕਈ ਸਾਰੇ ਕਾਂਗਰਸ ਦੇ ਲੀਡਰ ਸੀ ਜਿਹੜੇ ਛੱਡ ਕੇ ਦੂਸਰੀਆਂ ਪਾਰਟੀਆਂ ਜਿਆਦਾਤਰ ਬੀ ਜੇ ਪੀ 'ਚ ਚਲੇ ਗਏ ਤਾਂ ਵੈਸੇ ਤਾਂ ਸਿਆਸਤਦਾਨ ਪੰਜਾਬ ਨੂੰ ਬਹੁਤ ਵਧੀਆ ਕੋਈ ਵੀ ਨਹੀਂ ਮਿਲਿਆ ਸਾਰਿਆਂ ਨੇ ਜਾਂ ਕਹਿ ਲਓ ਵੀ ਕਿਸੇ ਵੀ ਸਿਆਸਤਦਾਨ ਨੇ ਆਪਣੀ ਸਰਕਾਰ ਦੇ ਸਮੇਂ ਦੇ ਵਿੱਚ ਪੰਜਾਬ ਦਾ ਕੋਈ ਬਹੁਤ ਜਿਆਦਾ ਤਰੱਕੀ ਵਾਲਾ ਕੋਈ ਕੰਮ ਨਹੀਂ ਕੀਤਾ ਪੰਜਾਬ ਦੇ ਵਿੱਚ ਕੋਈ ਵੀ ਵੱਡੀ ਜਿਹੜੀ ਇੰਡਸਟਰੀ ਜਾ ਕੋਈ ਜਿਹਨੂੰ ਆਪਾਂ ਕਹੀਏ ਕਾਰਖਾਨੇ ਨਹੀਂ ਲੱਗੇ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਲਈ ਦੂਜੀਆਂ ਜਿਹੜੀਆਂ ਸਟੇਟਾਂ ਜਾਂ ਰਾਜ ਨੇ ਉਥੇ ਜਾਣਾ ਪੈਂਦਾ ਹੈਗਾ ਤੇ ਪੰਜਾਬ ਦੀ ਕਿਸੇ ਟਾਈਮ ਜਿੰਨੀ ਤਰੱਕੀ ਸੀ ਜਾਂ ਜੋ ਰੁਤਬਾ ਸੀ ਉਹ ਅੱਜ ਦੀ ਡੇਟ 'ਚ ਨਹੀਂ ਹੈ ਤਾਂ ਸਿਆਸਤਦਾਨ ਜਿਹੜੇ ਹੈਗੇ ਆ ਉਹਨਾਂ ਨੇ ਪੰਜਾਬ ਦਾ ਕੋਈ ਜਿਆਦਾ ਭਲਾ ਨਹੀਂ ਕੀਤਾ ਤੇ ਹੁਣ ਦੇਖੋ ਦੋ ਸਾਲ ਬਾਅਦ ਫਿਰ ਇਲੈਕਸ਼ਨ ਹੈ ਕਿਸ ਤਰ੍ਹਾਂ ਦੀ ਗੌਰਮੈਂਟ ਆਉਂਦੀ ਹੈ ਕਿਸ ਤਰ੍ਹਾਂ ਦੀ ਸਰਕਾਰ ਕਿਸ ਤਰ੍ਹਾਂ ਦੇ ਸਿਆਸਤਦਾਨ ਕਿੱਦਾਂ ਪੰਜਾਬ ਨੂੰ ਚਲਾਉਂਦੇ ਹਨ ਧੰਨਵਾਦ